ਹਾਂਜੀ ਮੈਨੂੰ ਇਹ ਲੱਗਦਾ ਹੈਗਾ ਕਿ ਆਪਣੇ ਆਪਾਂ ਧਰਤੀ ਤੋਂ ਬਗੈਰ ਵੀ ਗ੍ਰਹਿਆਂ 'ਤੇ ਰਹਿ ਸਕਦੇ ਜਿਵੇਂ ਕਿ ਚੰਦਰਮਾ 'ਤੇ ਤਾਂ ਮੈਂ ਪੜ੍ਹਿਆ ਆਪਣੇ ਅੱਠਵੀਂ ਕਲਾਸ ਦੇ ਵਿੱਚ ਕਿ ਚੰਦਰਮਾ 'ਤੇ ਵੀ ਲੋਕ ਰਹਿ ਸਕਦੇ ਆ ਪਰ ਉੱਥੇ ਕੀ ਹੈਗਾ ਕਿ ਚੰਦਰਮਾ ਦੇ ਉੱਪਰ ਜਿਹੜੇ ਕਿ ਲੋਕ ਨੇ ਉਹ ਜ਼ਿਆਦਾਤਰ ਤੁਰ ਫਿਰ ਨਹੀਂ ਸਕਦੇ ਤਾਂ ਮੈਨੂੰ ਇਹ ਲੱਗਦਾ ਹੈਗਾ ਵੀ ਆਪਾਂ ਧਰਤੀ ਤੋਂ ਜ਼ਿਆਦਾ ਸੁਰੱਖਿਅਤ ਜੀਵਨ ਕਿਤੇ ਹੋਰ ਨਹੀਂ ਹੋ ਸਕਦਾ ਕਿਉਂਕਿ ਇੱਥੇ ਆਪਾਂ ਖੁੱਲ੍ਹ ਕੇ ਤੁਰ ਫਿਰ ਸਕਦੇ ਹੈਗੇ ਹਾਂ ਖਾਣ ਪੀਣ ਦਾ ਉਹ ਹੁੰਦਾ ਹੈਗਾ ਤਾਂ ਚੰਦਰਮਾ 'ਤੇ ਵੀ ਲੋਕ ਰਹਿ ਸਕਦੇ ਹੈਗੇ ਆ ਜੇ ਉੱਥੇ ਪਾਣੀ ਦੀ ਜਿਹੜੀ ਕਿ ਕਮੀ ਆ ਉਹ ਪੂਰੀ ਕਰ ਦਿੱਤੀ ਜਾਵੇ ਪਰ ਮੈਨੂੰ ਇਹ ਲੱਗਦਾ ਹੈਗਾ ਕਿ ਸਭ ਤੋਂ ਬੈਸਟ ਹੈ ਜਿਹੜਾ ਕਿ ਧਰਤੀ 'ਤੇ ਰਹਿਣਾ ਹੀ ਹੈਗਾ ਕਿਉਂਕਿ ਇੱਥੇ ਆਪਣੀਆਂ ਸਾਰੀਆਂ ਜਿਹੜੀਆਂ ਕਿ ਜ਼ਰੂਰਤਾਂ ਪੂਰੀਆਂ ਹੁੰਦੀਆਂ ਧਰਤੀ ਦੇ ਉੱਪਰ ਆਪਾਂ ਨੂੰ ਰਹਿ ਕੇ ਹੀ ਸਭ ਕੁਛ ਮਿਲਦਾ ਤਾਂ ਜ਼ਿਆਦਾਤਰ ਜਿਹੜਾ ਕਿ ਹੈਗਾ ਧਰਤੀ ਹੈ ਬਾਕੀ ਜੇ ਪੜ੍ਹਨ ਦੀ ਗੱਲ ਕਰੀਏ ਤਾਂ ਮੈਟਰਿਕ ਦੇ ਵਿੱਚ ਮੈਂ ਅੱਠਵੀਂ ਕਲਾਸ ਦੇ ਵਿੱਚ ਪੜ੍ਹਿਆ ਹੈਗਾ ਕਿ ਚੰਦਰਮਾ ਦੇ ਉੱਪਰ ਰਹਿਣ ਯੋਗ ਲੋਕ ਹੈਗੇ ਆ ਪਰ ਉਹ ਉੱਥੇ ਇੰਨਾ ਜ਼ਿਆਦਾ ਸੇਫ ਨਹੀਂ ਹੈਗਾ ਕਿਉਂਕਿ ਤੁਰਿਆ ਫਿਰਿਆ ਨਹੀਂ ਜਾਂਦਾ ਹੈਗਾ ਖੁੱਲ੍ਹ ਕੇ ਪਾਣੀ ਦੀ ਵੀ ਬਹੁਤ ਜ਼ਿਆਦਾ ਕਮੀ ਹੈਗੀ ਬੈਸਟ ਲੱਗਦਾ ਹੈਗਾ ਤਾਂ ਲੋਕਾਂ ਦੇ ਲਈ ਜੋ ਵੀ ਹੈ ਤਾਂ ਉਹ ਧਰਤੀ ਹੀ ਹੈਗੀ ਆ ਧਰਤੀ ਤੋਂ ਬਗੈਰ ਬੰਦਾ ਜੀਵਤ ਨਹੀਂ ਰਹਿ ਸਕਦਾ ਹੈਗਾ